ਮੈਂ ਛੁੱਟੀਆਂ ਦੇ ਵਿੱਚ ਹਿਮਾਚਲ ਜਾਣਾ ਜ਼ਿਆਦਾ ਪਸੰਦ ਕਰਦਾ ਹਿਮਾਚਲ ਦਾ ਇਲਾਕਾ ਮਕਲੋੜਗੰਜ ਕਿਉਂਕਿ ਉੱਥੋਂ ਦਾ ਮੌਸਮ ਬਹੁਤ ਵਧੀਆ ਹੁੰਦਾ ਹੈ ਅਤੇ ਨਾਲੇ ਉੱਥੇ ਬਹੁਤ ਜ਼ਿਆਦਾ ਠੰਡ ਧੁੰਦ ਅਤੇ ਬੱਦਲਾਂ ਵਿੱਚ ਘੁੰਮਣਾ ਪਸੰਦ ਲੱਗਦਾ ਹੈ ਅਤੇ ਉੱਥੋਂ ਦਾ ਜਿਹੜਾ ਵਾਤਾਵਰਨ ਉਹ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਅਤੇ ਉੱਥੇ ਘੁੰਮਣ ਨਾਲ ਮੇਰਾ ਮਾਇੰਡ ਜਿਹੜਾ ਜੋ ਥੱਕਿਆ ਹੁੰਦਾ ਹੈ ਸਾਰਾ ਸਾਲ ਉਹ ਫਰੈਸ਼ ਹੋ ਜਾਂਦਾ ਇਸ ਕਰਕੇ ਮੈਂ ਮਕਲੋੜਗੰਜ ਜਾਂ ਮਨਸੂਰੀ ਜਾਂ ਡਲਹੋਜੀ ਇਸ ਜਗ੍ਹਾ 'ਤੇ ਜਾ ਕੇ ਜ਼ਿਆਦਾ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦਾ ਜਦੋਂ ਵੀ ਮੈਂ ਤੰਗ ਆ ਜਾਂਦਾ ਜਾਂ ਥੋੜ੍ਹਾ ਜਿਹਾ ਜਿਹਨੂੰ ਕਹਿ ਸਕਦੇ ਹਾਂ ਵੀ ਆਪਾਂ ਆਪਣੇ ਆਪ ਨੂੰ ਜ਼ਿਆਦਾ ਕੰਮ ਕਰਕੇ ਆਪਾਂ ਥੱਕ ਜਾਂਦੇ ਹਾਂ ਤਾਂ ਮੈਂ ਇਹੀ ਚਾਹੁੰਦਾ ਵੀ ਉੱਥੇ ਜਾ ਕੇ ਘੁੰਮਣ ਦੇ ਨਾਲ ਮੇਰਾ ਜਿਹੜਾ ਮਾਇੰਡ ਉਹ ਫਰੈਸ਼ ਹੋ ਜਾਂਦਾ ਅਤੇ ਨਾਲ ਆਪਣੇ ਦੋਸਤਾਂ ਦੇ ਨਾਲ ਜਾ ਕੇ ਉੱਥੇ ਇੰਜੋਏ ਕਰੀਦਾ ਅਤੇ ਉੱਥੋਂ ਦਾ ਜਿਹੜਾ ਨੈਚੁਰਲ ਆ ਉਹਨੂੰ ਜ਼ਿਆਦਾ ਜਿਹੜਾ ਵਾ ਉਹ ਵਧੀਆ ਤਰੀਕੇ ਨਾਲ ਮਨਾਉਂਦੇ ਆ ਅਤੇ ਜਿਹੜਾ ਉੱਥੇ ਦਾ ਮੌਸਮ ਬਹੁਤ ਵਧੀਆ ਲੱਗਦਾ ਬਸ ਇਸੇ ਕਰਕੇ ਮੈਂ ਹਿਮਾਚਲ ਜਾ ਕੇ ਜ਼ਿਆਦਾ ਖੁਸ਼ ਹੁੰਦਾ ਹਾਂ